ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਅਤੇ ਹੋਰ ਸਾਰਿਆਂ ਨੂੰ ਮਿਲਣ ਦੇ ਕਈ ਲਾਭ ਹਨ ਜਿਵੇਂ ਕਿ ਅਸੀਂ ਲੇਹ ਲਦਾਖ ਦੇ ਟੂਰ 'ਤੇ ਜਾਂਦੇ ਹਾਂ ਉੱਥੇ ਸਾਨੂੰ ਕਈ ਤਰ੍ਹਾਂ ਦੇ ਯਾਤਰੀ ਮਿਲਦੇ ਜਿਹੜੇ ਸਾਨੂੰ ਨਾਲ ਫੋਟੋਆਂ ਕਰਾਉਣ ਨੂੰ ਬੜੇ ਹੀ ਖੁਸ਼ ਹੁੰਦੇ ਹਨ ਜਿਵੇਂ ਕਿ ਕਈ ਬੱਚੇ ਆ ਸਾਨੂੰ ਰਾਹ ਵਿੱਚ ਮਿਲ ਜਾਂਦੇ ਹਨ ਜਿਹਨਾਂ ਨਾਲ ਅਸੀਂ ਫੋਟੋਆਂ ਕਰਾ ਸਕਦੇ ਹਾਂ ਜਾਂ ਉਹਨਾਂ ਨੂੰ ਕਹਿ ਸਕਦੇ ਹਾਂ ਸਾਡੀਆਂ ਫੋਟੋਆਂ ਖਿੱਚ ਦਿਓ ਕਮਿਊਨਿਟੀ ਦੇ ਵਿੱਚ ਜਾਣ ਦਾ ਇਹ ਫਾਇਦਾ ਹੈ ਕਿ ਜੇ ਸਾਨੂੰ ਕੋਈ ਵੀ ਰਾਹ ਵਿੱਚ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਸਾਡੇ ਨਾਲ ਲੋਕ ਬੰਦੇ ਤਾਂ ਹੈ ਨਾ ਜਿਹੜੇ ਸਾਡੀ ਰਾਹ ਵਿੱਚ ਕੇਅਰ ਕਰ ਸਕਦੇ ਆ ਨਾਲੇ ਜੇ ਕੱਲ ਆਪਾਂ ਮੈਂ ਇਕੱਲੇ ਪ੍ਰੈਫਰੈਂਸ ਨਹੀਂ ਦਿੰਦਾ ਕਿਉਂਕਿ ਇਕੱਲੇ ਰਹਿਣ ਨਾਲ ਸਾਨੂੰ ਇਹ ਹੋ ਸਕਦਾ ਕਿ ਸਾਨੂੰ ਰਾਹ ਵਿੱਚ ਕੋਈ ਵੀ ਦਿੱਕਤ ਆ ਸਕਦੀ ਹੈ ਜਿਹਦੇ ਨਾਲ ਸਾਨੂੰ ਸਾਡੀ ਜਾਨ ਨੂੰ ਵੀ ਹਾਨੀ ਹੋ ਸਕਦੀ ਹੈ ਜੇ ਸਾਡੇ ਕੋਲ ਸਾਨੂੰ ਰਾਹ ਵਿੱਚ ਕੋਈ ਚੀਜ਼ ਨਾ ਮਿਲੇ ਕੋਈ ਐਟ ਏ ਟਾਈਮ ਸਾਨੂੰ ਕੋਈ ਚੀਜ਼ ਨਾ ਵਰਤੋਂ ਨਾ ਕਰੇ ਜੋ ਸਾਨੂੰ ਸਾਡੇ ਲਈ ਲਾਭਦਾਇਕ ਵੀ ਹੋ ਸਕਦੀ ਹੈ ਜਾਂ ਹਾਨੀਕਾਰਕ ਵੀ ਹੋ ਸਕਦੀ ਹੈ